ਲੋਕਾਂ ਨੂੰ ਦੇਖਣ ਲਈ ਆਪਣੀ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਤਾਂ ਸਨ ਅਤੇ ਮੈਂ ਇੱਕ ਵਿਆਹ 'ਤੇ ਜਦੋਂ ਗਈ ਸੀ ਉਦੋਂ ਕਿੰਨੀਆਂ ਸਾਰੀਆਂ ਮੈਂ ਤਸਵੀਰਾਂ ਖਿੱਚਵਾਈਆਂ ਸਨ ਅਤੇ ਮੈਂ ਘਰ ਆ ਕੇ ਆਪਣੇ ਮਾਂ ਪਿਓ ਨੂੰ ਜਦੋਂ ਤਸਵੀਰਾਂ ਵਿਖਾਈਆਂ ਤਾਂ ਉਨ੍ਹਾਂ ਨੂੰ ਬੜਾ ਚੰਗਾ ਲੱਗਾ ਉਨ੍ਹਾਂ ਨੂੰ ਵੀ ਇੱਦਾਂ ਲੱਗਾ ਕਿ ਜਿਵੇਂ ਉਹ ਵੀ ਵਿਆਹ ਵਿੱਚ ਸ਼ਾਮਿਲ ਸਨ ਕਈ ਮਜ਼ਬੂਰੀਆਂ ਕਾਰਨ ਉਹ ਵਿਆਹ ਵਿੱਚ ਨਹੀਂ ਜਾ ਪਾ ਰਹੇ ਸਨ ਅਤੇ ਜਦੋਂ ਮੈਂ ਆ ਕੇ ਘਰ ਉਨ੍ਹਾਂ ਨੂੰ ਆਪਣੀਆਂ ਤਸਵੀਰਾਂ ਵਿਖਾਈਆਂ ਤਾਂ ਉਹ ਬੜੇ ਖੁਸ਼ ਹੋਏ ਲੋਕਾਂ ਨੂੰ ਤਾਂ ਨਹੀਂ ਪਰ ਮਾਂ ਪਿਓ ਨੂੰ ਰਿਸ਼ਤੇਦਾਰਾਂ ਨੂੰ ਆਪਣੀਆਂ ਤਸਵੀਰਾਂ ਜ਼ਰੂਰ ਪ੍ਰਦਰਸ਼ਿਤ ਕੀਤੀਆਂ ਹਨ ਮੇਰਾ ਤਜ਼ਰਬਾ ਰਿਸ਼ਤੇਦਾਰਾਂ ਨਾਲ ਬੜਾ ਵਧੀਆ ਰਿਹਾ ਉਨ੍ਹਾਂ ਨੂੰ ਵੀ ਇੱਦਾਂ ਦਾ ਹੀ ਲੱਗਿਆ ਜਿਵੇਂ ਉਹ ਉਸ ਜਗ੍ਹਾ 'ਤੇ ਪਹੁੰਚ ਗਏ ਹਨ ਉਨ੍ਹਾਂ ਨੇ ਵੀ ਬੜੀ ਖੂਬਸੂਰਤੀ ਨਾਲ ਆਪਣੇ ਤਸਵੀਰਾਂ ਦਾ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ਲੱਗਿਆ ਕਿ ਅਸੀਂ ਵੀ ਉੱਥੇ ਹੀ ਸੀਗੇ ਤਜ਼ਰਬਾ ਤਾਂ ਬਹੁਤ ਵਧੀਆ ਰਿਹਾ ਮੈਨੂੰ ਬਹੁਤ ਖੁਸ਼ੀ ਮਿਲੀ ਸਾਰਿਆਂ ਨੂੰ ਤਸਵੀਰਾਂ ਬੜੀਆਂ ਪਸੰਦ ਆਈਆਂ ਸਾਰਿਆਂ ਨੂੰ ਇੱਦਾਂ ਲੱਗਾ ਕਿ ਜਿਵੇਂ ਅਸੀਂ ਵੀ ਉੱਧਰ ਹਨ ਅਤੇ ਬੜੀ ਸੋਹਣੀਆਂ ਤਸਵੀਰਾਂ ਪ੍ਰਦਰਸ਼ਿਤ ਹੋਈਆਂ ਮੈਂ ਵਿਆਹ ਦੀ ਸਾਰੀਆਂ ਉਨ੍ਹਾਂ ਨੂੰ ਤਸਵੀਰਾਂ ਵਿਖਾਈਆਂ ਉਨ੍ਹਾਂ ਨੂੰ ਬੜੀ ਖੁਸ਼ੀ ਮਿਲੀ ਅਤੇ ਉਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਵੀ ਤਸਵੀਰਾਂ ਇੰਨੀਆਂ ਹੀ ਸੋਹਣੀਆਂ ਆਉਣ ਅਤੇ ਸਾਰਿਆਂ ਦਾ ਮਨ ਖੁਸ਼ ਹੋ ਜਾਵੇ ਧੰਨਵਾਦ